ਮੈਂ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹਾਂ ਸਾਨੂੰ ਜ਼ਿਆਦਾਤਰ ਸਮਾਨ ਲੈਣ ਲਈ ਦੂਰ ਸ਼ਹਿਰ ਜਾਣਾ ਪੈਂਦਾ ਹੈ ਵਿਆਹ ਸਾਨੂੰ ਕਈ ਪ੍ਰੋਗਰਾਮਾਂ ਜਿਵੇਂ ਕਿ ਵਿਆਹ ਵਿਆਹਾਂ ਜਾਂ ਹੋਰ ਕੋਈ ਵੀ ਵੱਡੇ ਸਮਰੋਹਾਂ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਸ਼ਹਿਰ ਤੋਂ ਟੈਂਕਰ ਮੰਗਵਾਉਣੇ ਪੈਂਦੇ ਹਨ ਆਮ ਤੌਰ 'ਤੇ ਲੋਕ ਸ਼ਹਿਰ ਤੋਂ ਦੋ ਟੈਂਕਰ ਮੰਗਵਾਉਂਦੇ ਹਨ ਇੱਕ ਟੈਂਕਰ ਨਹਾਉਣ ਵਾਲੇ ਪਾਣੀ ਲਈ ਵਰਤਿਆ ਜਾਂਦਾ ਹੈ ਦੂਸਰਾ ਟੈਂਕਰ ਪੀਣ ਵਾਲੇ ਪਾਣੀ ਲਈ ਵਰਤਿਆ ਜਾਂਦਾ ਹੈ ਪਰ ਕੁਝ ਗਰੀਬ ਲੋਕ ਆਪਣੀ ਸਮਰੱਥਾ ਦੇ ਅਨੁਸਾਰ ਇੱਕੋ ਹੀ ਟੈਂਕਰ ਮੰਗਵਾਉਂਦੇ ਹਨ ਉਹ ਹੀ ਟੈਂਕਰ ਦੀ ਵਰਤੋਂ ਨਾਲ ਉਹ ਨਹਾਉਂਦੇ ਹਨ ਉਹ ਹੀ ਟੈਂਕਰ ਨਾਲ ਉਹ ਨਾਲ ਹੀ ਉਹ ਪਾਣੀ ਪੀਂਦੇ ਹਨ ਅਤੇ ਇਹ ਸਹੀ ਵੀ ਹੈ ਕਿ ਨਹਾਉਣ ਵਾਲਾ ਪਾਣੀ ਅਤੇ ਪੀਣ ਵਾਲਾ ਪਾਣੀ ਅਲੱਗ ਹੋਣਾ ਚਾਹੀਦਾ ਹੈ ਪਰ ਜਾ ਆਮ ਤੌਰ 'ਤੇ ਜ਼ਿਆਦਾਤਰ ਲੋਕ ਤਾਂ ਦੋ ਟੈਂਕਰ ਹੀ ਮੰਗਵਾਉਂਦੇ ਹਨ